ਮੈਂ ਆਪਦੀ ਨੌਜਵਾਨ ਪੀੜ੍ਹੀ ਨੂੰ ਖ਼ਬਰਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦੀ ਹਾਂ ਖ਼ਬਰਾਂ ਵਿੱਚ ਖੇਡ ਨਾਲ ਸੰਬੰਧਿਤ ਖੇਡਾਂ ਵਿੱਚ ਭਾਗ ਲੈਣਾ ਜ਼ਰੂਰੀ ਹੈ ਮੈਂ ਉਹਨਾਂ ਨੂੰ ਇਹ ਕਹਿੰਦੀ ਹਾਂ ਕਿ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਆਪਦੀ ਸਿਹਤ ਬਣਾਉਣ ਅਤੇ ਸਿਹਤ ਨੂੰ ਮਜ਼ਬੂਤ ਕਰਨ ਅਤੇ ਮੈਂ ਆਪਦੀ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਆ ਨਸ਼ਿਆਂ ਤੋਂ ਦੂਰ ਰਹਿਣ ਜਦੋਂ ਖੇਡਾਂ ਵਿੱਚ ਹਿੱਸਾ ਲੈਣਗੇ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਆਪਦੇ ਮਾਨਸਿਕ ਤਨਾਅ ਤੋਂ ਵੀ ਮਜ਼ਬੂਤ ਰਹਿਣਗੇ ਅਤੇ ਪੜ੍ਹਾਈ ਬਾਰੇ ਪੜ੍ਹਾਈ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਪੜਾਈ ਕਰੋਗੇ ਤਾਂ ਕੋਈ ਨੌਕਰੀ ਮਿਲੂਗੀ ਨੌਕਰੀ ਲਓ ਨੌਕਰੀ ਲਓਗੇ ਬਾਹਰ ਜਾ ਸਕਦੇ ਹੋ ਬਾਹਰ ਜਾ ਕੇ ਚੰਗੇ ਪੈਸੇ ਕਮਾ ਸਕਦੇ ਹੋ ਮੈਂ ਆਪਦੀ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਰਾਜਨੀਤੀ ਵਿੱਚ ਹਿੱਸਾ ਲਓ ਰਾਜਨੀਤੀ ਕਰੋਗੇ ਤਾਂ ਆਪਦੇ ਪਿੰਡ ਦਾ ਵਿਕਾਸ ਕਰੋਗੇ ਆਪਦੇ ਲਾਗੇ ਆਲਾ ਦੁਆਲਾ ਸਾਫ਼ ਰੱਖੋਗੇ ਅਤੇ ਤੁਸੀਂ ਬਹੁਤ ਵਧੀਆ ਆਪਦਾ ਪਿੰਡ ਸੁਧਾਰ ਸਕਦੇ ਹੋ ਸ਼ਹਿਰ ਸੁਧਾਰ ਸਕਦੇ ਹੋ